ਮੈਂ ਪਕਵਾਨ ਬਣਾਉਣ ਦੇ ਵਿੱਚ ਬਹੁਤ ਹੀ ਮਾਹਿਰ ਸੀ ਅਤੇ ਜਦੋਂ ਮੈਂ ਆਪਣੇ ਪਕਵਾਨਾਂ ਦੇ ਬਾਰੇ ਆਪਣੀਆਂ ਸਹੇਲੀਆਂ ਕੋਲ ਗੱਲ ਕਰਦੀ ਹੁੰਦੀ ਹਾਂ ਤਾਂ ਮੈਂ ਉਹਨਾਂ ਨੂੰ ਦੱਸਦੀ ਹੁੰਦੀ ਹਾਂ ਕਿ ਪਕਵਾਨ ਕਿਸ ਤਰ੍ਹਾਂ ਬਣਾਏ ਜਾਂਦੇ ਹਾਂ ਤਾਂ ਉਹ ਵੀ ਧਿਆਨ ਨਾਲ ਸੁਣਦੀਆਂ ਨੇ ਮੈਂ ਗੁਲਗਲੇ ਜਦੋਂ ਬਣਾਉਂਦੀ ਹਾਂ ਤਾਂ ਉਸਦੇ ਲਈ ਮੈਂ ਪਹਿਲਾਂ ਸ਼ੱਕਰ ਘੋਲਦੀ ਹਾਂ ਪਾਣੀ ਦੇ ਵਿੱਚ ਅਤੇ ਉਸਦੇ ਵਿੱਚ ਹੀ ਫਿਰ ਮੈਂ ਆਟਾ ਘੋਲ ਦਿੰਦੀ ਹਾਂ ਅਤੇ ਫਿਰ ਮੈਂ ਇਹ ਸਾਰੀ ਸਮੱਗਰੀ ਆਪਣੀ ਸਹੇਲੀਆਂ ਨੂੰ ਦੱਸਦੀ ਹਾਂ ਕਿ ਇਸ ਤਰ੍ਹਾਂ ਸਾਰਾ ਕੁਛ ਤਿਆਰ ਕਰਨ ਤੋਂ ਬਾਅਦ ਮੈਂ ਗੁਲਗੁਲੇ ਬਣਾਉਂਦੀ ਹਾਂ ਅਤੇ ਕਚੋਰੀਆਂ ਬਣਾਉਣ ਦੇ ਲਈ ਵੀ ਮੈਂ ਸਭ ਤੋਂ ਪਹਿਲਾਂ ਆਲੂਆਂ ਨੂੰ ਸੀਟੀਆਂ ਮਰਾਉਂਦੀ ਹਾਂ ਅਤੇ ਫਿਰ ਉਸ ਤੋਂ ਬਾਅਦ ਫਿਰ ਸਾਰੀ ਆਲੂਆਂ ਦੀ ਤਿਆਰੀ ਕਰਨ ਤੋਂ ਬਾਅਦ ਲੂਣ ਮਿਰਚ ਮਸਾਲਾ ਰਲਾਉਣ ਤੋਂ ਬਾਅਦ ਫਿਰ ਮੈਂ ਆਟਾ ਗੁੰਨਦੀ ਹਾਂ ਆਟਾ ਗੁੰਨਣ ਤੋਂ ਬਾਅਦ ਫਿਰ ਮੈਂ ਉਹ ਮਸਾਲੇ ਦੇ ਦੁਆਰਾ ਆਟੇ ਦੇ ਵਿੱਚ ਪੇੜੇ ਕੱਢ ਕੇ ਕਚੋਰੀਆਂ ਬਣਾਉਂਦੀ ਹਾਂ ਅਤੇ ਕਿਸ ਤਰ੍ਹਾਂ ਤਲਦੀ ਹਾਂ ਮੈਂ ਸਭ ਕੁਝ ਆਪਣੀ ਸਹੇਲੀਆਂ ਨੂੰ ਦੱਸਦੀ ਹਾਂ